ਸਤਾਈ ਸਤੰਬਰ ਉੱਨੀ ਸੌ ਬਾਨਵੇਂ ਛੱਬੀ ਅਕਤੂਬਰ ਉੱਨੀ ਸੌ ਤ੍ਰਿਆਨਵੇਂ ਦਸ ਅਗਸਤ ਦੋ ਹਜ਼ਾਰ ਵੀਹ ਤੇਰਾਂ ਮਾਰਚ ਦੋ ਹਜ਼ਾਰ ਨੌ ਪੰਜ ਮਾਰਚ ਉੱਨੀ ਸੌ ਇਕਹੱਤਰ